ਜਿਵੇਂ ਕਿ ਅੱਜ ਕੱਲ ਸੋਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਘਰਾਂ ਦੇ ਵਿੱਚ ਹਨਾ ਜਿਆਦਾਤਰ ਮਤਲਬ ਸਲੰਡਰ ਹੀ ਯੂਜ ਕੀਤੇ ਜਾਂਦੇ ਆ ਜਿੰਨਾਂ ਵਿੱਚ ਕੀ ਐਲ ਪੀ ਜੀ ਗੈਂਸ ਭਰੀ ਹੁੰਦੀ ਹੈ ਜਿਹੜੀ ਐਲ ਪੀ ਜੀ ਗੈਸ ਹੁੰਦੀ ਆ ਇਹ ਬਹੁਤ ਛੇਤੀ ਆ ਜਿਹੜੀ ਉਹ ਅੱਗ ਨੂੰ ਫੜ ਲੈਂਦੀ ਹੈ ਤਾਂ ਕਰਕੇ ਇਸ ਨੂੰ ਵਰਤਣ ਦੇ ਕੁਝ ਲੀਏ ਸਾਵਧਾਨੀਆਂ ਆਪਾਂ ਨੂੰ ਵਰਤਣੀਆਂ ਚਾਹੀਦੀਆ ਜਿਵੇਂ ਕੀ ਜਿਹੜੀ ਐਲ ਪੀ ਜੀ ਜਿਹੜਾ ਕੀ ਐਲ ਪੀ ਜੀ ਸਿਲੰਡਰ ਹੁੰਦੇ ਆ ਪਹਿਲਾਂ ਤਾਂ ਆਪਾਂ ਨੂੰ ਇਹ ਸੁਨਿਕਸ਼ਿਤ ਕਰਨਾ ਚਾਹੀਦਾ ਕਿ ਜਿਹੜੀ ਉਹਦੀ ਸੀਲ ਹੈਗੀ ਆ ਉਹ ਚੰਗੀ ਤਰ੍ਹਾਂ ਨਾਲ ਬੰਦ ਹੋਣੀ ਚਾਹੀਦੀ ਆ ਉਹਦੇ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਹੋਣੀ ਚਾਹੀਦੀ ਜੇ ਤਾਂ ਕਿ ਉਹ ਕਿਤੇ ਤਾਂ ਕਿ ਉਹਨੂੰ ਵਿਸਫ਼ੋਟ ਹੋਣ ਤੋਂ ਬਚਾਇਆ ਜਾ ਸਕੇ ਦੂਸਰਾ ਕਿ ਆਪਾਂ ਉਹਨੂੰ ਉਹਦੇ ਕੋਲ ਕੋਈ ਵੀ ਐਵੇਂ ਦੀ ਚੀਜ਼ ਨਹੀਂ ਰੱਖਣੀ ਚਾਹੀਦੀ ਜਿਹੜੀ ਕੀ ਛੇਤੀ ਲੀ ਮਤਲਬ ਅੱਗ ਫੜਦੀ ਹੋਵੇ ਜਿਵੇਂ ਕਿ ਕੈਰੋਸ਼ੀਨ ਹੋ ਗਿਆ ਥਰਡ ਹੀ ਆਪਾਂ ਨੂੰ ਇਹ ਕਾਲਾ ਬਾਜ਼ਾਰ ਆਲਿਆਂ ਤੋਂ ਨਹੀਂ ਖਰੀਦਣਾ ਚਾਹੀਦਾ ਇਹ ਵੀ ਸੁਨਿਕਸ਼ਿਤ ਕਰਨਾ ਚਾਹੀਦਾ ਕਿ ਜਿਹੜਾ ਇਹਦਾ ਮਾਲਿਕ ਹੈਗਾ ਉਹ ਚ ਸਹੀ ਤਾਂ ਹੈਗਾ ਨਾ ਮਤਲਬ ਅਸਲੀ ਹੈਗਾ ਤੇ ਫੋਰਥ ਸਾਨੂੰ ਇਸਦੀ ਸਾਨੂੰ ਜਿਹੜਾ ਐਲ ਪੀ ਜੀ ਸਿਲੰਡਰ ਹੈਗਾ ਇਸਨੂੰ ਬੱਚਾ ਬੱਚਿਆਂ ਨੂੰ ਵੀ ਇਸ ਇਹਨੂੰ ਇਸ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਕੁਝ ਬੱ ਕਿਉਂਕਿ ਬੱਚਿਆਂ ਨੂੰ ਤਾਂ ਹਨਾ ਇਹਦੇ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ ਤਾਂ ਕਰਕੇ ਤੇ